ਯੋਗਾ ਨੂੰ ਬੇਸ਼ੱਕ ਕਸਰਤ ਦਾ ਰੂਪ ਸਮਝ ਲਿਆ ਜਾਂਦਾ ਪਰ ਜੇ ਅਸੀਂ ਮਤਲਬ ਬਹੁਤ ਹੀ ਮਹੀਨ ਛਾਣਨੀ ਲਾ ਦਈਏ ਤਾਂ ਦੋਹਾਂ 'ਚ ਕਾਫੀ ਫਰਕ ਹੈ ਕਸਰਤ ਸਿਰਫ ਸਾਡੀ ਬਾਡੀ ਨੂੰ ਹਰਕਤ ਦਿੰਦੀ ਹੈ ਜਾਂ ਅਸੀਂ ਆਪਦੀ ਸਰੀਰ ਦੀ ਵਰਜਿਸ਼ ਜਾਂ ਮਤਲਬ ਸਰੀਰ ਨੂੰ ਇਕਾਗਰਤਾ ਦੇਣ ਲਈ ਅਸੀਂ ਕਸਰਤ ਕਰਦੇ ਹਾਂ ਪਰ ਯੋਗਾ ਸਾਡੇ ਬਹੁਤ ਸਾਰੇ ਮਨ ਦੀਆਂ ਸ਼ਕਤੀਆਂ ਨੂੰ ਮਨ ਦੀਆਂ ਅੰਦਰੂਨੀ ਇੰਦਰੀਆਂ ਨੂੰ ਜਿਹੜਾ ਹੈ ਉਹ ਸ਼ਕਤੀ ਦਿੰਦਾ ਹੈ ਊਰਜਾ ਦਿੰਦਾ ਹੈ ਪੁਰਾਣੇ ਸਮੇਂ ਵਿੱਚ ਜਿਹੜਾ ਯੋਗ ਅਭਿਆਸ ਸੀ ਉਹਨੂੰ ਸੰਤ ਮਹਾਤਮਾ ਰਿਸ਼ੀਆਂ ਮੁਨੀਆਂ ਨਾਲ ਵੀ ਜੋੜਿਆ ਜਾਂਦਾ ਸੀ ਪਰ ਕਸਰਤ ਜਿਹੜੀ ਹੈ ਉਹ ਸਿਰਫ ਸਾਡੀ ਬਾਡੀ ਫਿਸ ਫਿਟਨੈਸ ਜਾਂ ਅਸੀਂ ਸਰੀਰਕ ਸਮਰੱਥਾ ਦੇ ਨਾਲ ਹੀ ਜੋੜ ਕੇ ਵੇਖਦੇ ਹਾਂ